ਹੈਲੋ ਹਾਂਜੀ ਤੁਸੀਂ ਰੋਪੜ ਤੋਂ ਗੱਲ ਕਰਦੇ ਹੋ ਜੀ ਸਤਿ ਸ਼੍ਰੀ ਅਕਾਲ ਅੱਛਾ ਜੀ ਮੈਂ ਮੈਮ ਜੁੱਤੀਆਂ ਲੈਣੀਆਂ ਸੀ ਵਿਆਹ ਆ ਰਿਹਾ ਸੀ ਮੇਰੇ ਭਾਣਜੇ ਦਾ ਇਸ ਕਰਕੇ ਮੈਨੂੰ ਲੱਗਦਾ ਮਤਲਬ ਪੰਜਾਬੀ ਜੁੱਤੀ ਲੈਣੀ ਸੀ ਇੱਕ ਹੀਲ ਵਾਲੀ ਵੀ ਲੈਣੀ ਸੀ ਮੈਮ ਜੁੱਤੀ ਤਾਂ ਹੋਵੇ ਤਿੰਨ ਚਾਰ ਸੌ ਤੱਕ ਮਤਲਬ ਹਾਂਜੀ ਉਹ ਵੀ ਚਾਹੀਦੇ ਹੈ ਸਪੋਰਟ ਸਪੋਰਟਸ ਸ਼ੂਜ਼ ਵੀ ਚਾਹੀਦੇ ਹੈ ਮੈਂ ਰਨਿੰਗ ਵੀ ਕਰਦੀ ਹਾਂ ਨਾ ਇਸ ਕਰਕੇ ਹਾਂਜੀ ਹਾਂਜੀ ਠੀਕ ਹੈ ਮੈਮ ਫੰਕਸ਼ਨੇਬਲ ਚਾਹੀਦੀਆਂ ਸੀ ਵਿਆਹ ਕਰਕੇ ਨਾ ਵੀ ਮਤਲਬ ਅੱਜ ਕੱਲ੍ਹ ਜਿਨ੍ਹਾਂ ਦਾ ਟਰੈਂਡ ਹੋਵੇ ਠੀਕ ਹੈ ਮੈਮ ਮਤਲਬ ਹੀਲ ਵਾਲੀਆਂ ਵੀ ਜੁੱਤੀਆਂ ਹੈਗੀਆਂ ਠੀਕ ਹੈ ਮੈਮ ਠੀਕ ਹੈ ਮੈਮ ਮੈਮ ਆਪਣਾ ਫੋਨ ਨੰਬਰ ਦੇ ਦੇਣਾ ਆਪਣਾ ਮੈਂ ਮਤਲਬ ਸੈਂਡ ਕਰ ਦੇਣਾ ਫਿਰ ਅਸੀਂ ਪਤਾ ਕਰ ਸਕਦੇ ਹਾਂ ਨਾ ਹਾਂਜੀ ਠੀਕ ਹੈ ਮੈਮ ਥੈਂਕ ਯੂ ਮੈਮ ਸਤਿ ਸ਼੍ਰੀ ਅਕਾਲ